ਪੰਜਾਬੀ ਲੋਕ ਆਪਣੇ ਸੱਭਿਆਚਾਰਕ ਪਰੰਪਰਾ ਨੂੰ ਮਾਣ ਅਤੇ ਸਨਮਾਨ ਦੇ ਦੇਣ ਲਈ ਆਪਣੀ ਭਾਸ਼ਾ ਦੀ ਵਰਤੋਂ ਬੜੇ ਸੁਚੱਜੇ ਢੰਗ ਦੇ ਨਾਲ ਕਰਦੇ ਹਨ ਉਹ ਹਰੇਕ ਨੂੰ ਜੀ ਕਹਿ ਕੇ ਬੁਲਾਉਂਦੇ ਹਨ ਅਤੇ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਦੇ ਨਾਲ ਆਪਣੀ ਜਿਹੜੀ ਭਾਸ਼ਾ ਦੇ ਨਾਲ ਪੇਸ਼ ਕਰਦੇ ਹਨ ਪਰ ਇਸ ਦੇ ਉਲਟ ਜਦੋਂ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹਦਾ ਪੰਜਾਬੀ ਲੋਕ ਗਾਲਾਂ ਨੂੰ ਵੀ ਆਪਣੀ ਭਾਸ਼ਾ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਪ੍ਰਯੋਗ ਕਰਦੇ ਹਨ ਇਸ ਗੱਲ ਨਾਲ ਉਹਨਾਂ ਦਾ ਵੱਡੇ ਪੱਧਰ ਦੇ ਉੱਤੇ ਮਨੋਬਲ ਵੱਧਦਾ ਹੈ ਜਿਸ ਕਾਰਨ ਉਹ ਆਪਣੀ ਗੱਲ ਪੁਗਾਉਣ ਦੇ ਵਿਚ ਵੱਡੇ ਪੱਧਰ ਦੇ ਉੱਤੇ ਕਾਮਯਾਬ ਹੁੰਦੇ ਹਨ ਜੇਕਰ ਕੋਈ ਗੱਲ ਜੇਕਰ ਕੋਈ ਕੰਮ ਸਿੱਧੇ ਢੰਗ ਦੇ ਨਾਲ ਨਾ ਹੁੰਦਾ ਦਿਖੇ ਤਾਂ ਪੰਜਾਬੀ ਲੋਕ ਆਪਣੀ ਭਾਸ਼ਾ ਦੀ ਵਰਤੋਂ ਇੰਝ ਕਰਦੇ ਹਨ ਜਿਵੇਂ ਸਿੱਧੀ ਉਂਗਲੀ ਨਾਲ ਘੇ ਨਹੀਂ ਨਿਕਲਿਆ ਜਾ ਸਕਦਾ ਪਰ ਉਹਨੂੰ ਪੁੱਠੀ ਕਰਨ ਦੇ ਵਿੱਚ ਜਾਂ ਵੀ ਟੇਢੀ ਕਰਨ ਦੇ ਕਾਰਨ ਉਸ ਕਾਮ ਕਾਮ ਨੂੰ ਕਾਮਯਾਬ ਕਰਨ ਵਿੱਚ ਸਫਲ ਹੁੰਦੇ ਹਨ ਸੋ ਪੰਜਾਬੀ ਲੋਕ ਆਪਣੀ ਮਾਂ ਬੋਲੀ ਨੂੰ ਪੰਜਾਬੀ ਨੂੰ ਵਧੀਆ ਮਾਣ ਸਨਮਾਨ ਦੇਣ ਦੇ ਲਈ ਇੰਟਰਨੈਸ਼ਨਲ ਲੈਵਲ 'ਤੇ ਨੈਸ਼ਨਲ ਲੈਵਲ 'ਤੇ ਪੰਜਾਬ ਲੈਵਲ ਦੇ ਉੱਤੇ ਵੱਡੇ ਵੱਡੇ ਸੱਭਿਆਚਾਰਕ ਪ੍ਰੋਗਰਾਮ ਜਿਹਦੇ ਵਿੱਚ ਗਿੱਧਾ ਭੰਗੜਾ ਅਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਪਰੰਪਰਾਵਾਂ ਹੈ ਜਿਹੜੇ ਰੀਤੀ ਰਿਵਾਜ਼ ਹੈ ਚਾਹੇ ਤਿਉਹਾਰ ਹੈ ਜਿਵੇਂ ਲੋਹੜੀ ਵਿਸਾਖੀ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਵਿੱਚ ਮਨਾ ਕੇ ਆਪਣੀ ਜਿਹੜੀ ਮਾਂ ਬੋਲੀ ਹੈ ਆਪਣੀਆਂ ਜਿਹੜੀਆਂ ਸੱਭਿਆਚਾਰਕ ਪਰੰਪਰਾਵਾਂ ਹੈ ਉਹਨੂੰ ਦੇਸ਼ ਵਿਦੇਸ਼ ਦੇ ਵਿੱਚ ਫੈਲਾਉਣ ਦੇ ਵਿੱਚ ਕਾਮਯਾਬ ਹੁੰਦੇ ਆ